ਜ਼ਿੰਦਗੀ ਵਿੱਚ ਚੁਣੌਤੀਆਂ ਤਾਂ ਹਰ ਇੱਕ ਨੂੰ ਹੀ ਸਾਹਮਣਾ ਕਰਨਾ ਪੈਂਦਾ ਹੈ ਚੁਣੌਤੀ ਦਾ ਇਹ ਨਹੀਂ ਪਤਾ ਕਿ ਵੱਡੀ ਹੈ ਜਾਂ ਛੋਟੀ ਹੈ ਜਦੋਂ ਬੰਦਾ ਉਸ ਸਿਚੂਏਸ਼ਨ ਦੇ ਵਿੱਚੋਂ ਨਿਕਲ ਰਿਹਾ ਹੁੰਦਾ ਹੈ ਤਾਂ ਬਸ ਉਹ ਹੀ ਚੁਣੌਤੀ ਵੱਡੀ ਲੱਗ ਰਹੀ ਹੁੰਦੀ ਹੈ ਭਾਵੇਂ ਉਹ ਛੋਟੀ ਹੀ ਹੋਵੇ ਜਦੋਂ ਸਮਾਂ ਨਿਕਲ ਜਾਂਦਾ ਹੈ ਅਤੇ ਉਸ ਤੋਂ ਬਾਅਦ ਉਹ ਹੀ ਚੁਣੌਤੀ ਫਿਰ ਬੰਦਾ ਜਦੋਂ ਹਲਕੇ ਪਲਾਂ ਵਿੱਚ ਆ ਜਾਂਦਾ ਹੈ ਫਿਰ ਉਹਨੂੰ ਉਹ ਪੁਰਾਣੇ ਵਾਲੀ ਜਿਹੜੀ ਚੁਣੌਤੀ ਹੈ ਉਹ ਫਿਰ ਉਹਨੂੰ ਲੱਗਣ ਲੱਗ ਜਾਂਦਾ ਇਹ ਤਾਂ ਕੁੱਛ ਵੀ ਨਹੀਂ ਸੀ ਇਹ ਤਾਂ ਛੋਟੀ ਜਿਹੀ ਗੱਲ ਸੀ ਪਰ ਜਦੋਂ ਉਹ ਬੰਦਾ ਉਸ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੁੰਦਾ ਉਹ ਟਾਈਮ ਚੱਲ ਰਿਹਾ ਹੁੰਦਾ ਉਹ ਪਲ ਚੱਲ ਰਿਹਾ ਹੁੰਦਾ ਹੈ ਉਦੋਂ ਉਹ ਹੀ ਚੁਣੌਤੀ ਉਹਨੂੰ ਬਹੁਤ ਵੱਡੀ ਲੱਗਦੀ ਹੈ ਅਤੇ ਹਰ ਥਾਂ 'ਤੇ ਕਦਮ ਕਦਮ 'ਤੇ ਕੁੱਛ ਨਾ ਕੁੱਛ 'ਚ ਕੋਈ ਨਾ ਕੋਈ ਚੁਣੌਤੀ ਜਿਹੜੀ ਸਾਹਮਣੇ ਆਉਂਦੀ ਓ ਰਹੀ ਹੈ ਲਾਈਫ਼ ਵਿੱਚ ਸ਼ੁਰਆਤ ਤੋਂ ਲੈ ਕੇ ਜਿਵੇਂ ਕਿ ਪਲੱਸ ਟੂ ਤੋਂ ਬਾਅਦ ਅਕਾਊਂਟ ਖੁੱਲ੍ਹਵਾਉਣਾ ਸੀ ਬੈਂਕ ਦੇ ਵਿੱਚ ਅਤੇ ਉੱਥੇ ਗਏ ਹਾਂ ਛੋਟੀ ਜਿਹੀ ਗੱਲ ਹੈ ਬਟ ਉਦੋਂ ਇਹ ਵੀ ਚੁਣੌਤੀ ਬਹੁਤ ਵੱਡੀ ਲੱਗ ਰਹੀ ਸੀ ਕਿਉਂਕਿ ਦਸ ਬਾਰ੍ਹਾਂ ਗੇੜੇ ਬੈਂਕ ਦੇ ਲੱਗ ਚੁੱਕੇ ਸੀ ਘਰ ਤੋਂ ਬੈਂਕ ਦੂਰ ਸੀ ਅਤੇ ਉਸ ਮਤਲਬ ਬੈਂਕ ਦੇ ਜਿਹੜੀ ਮਤਲਬ ਸੀ ਜੋ ਵੀ ਉਹਨਾਂ ਦੇ ਸੀ ਬੰਦੇ ਸੀ ਸਟਾਫ ਸੀ ਬਿਲਕੁਲ ਉਹਨਾਂ ਵੱਲੋਂ ਕੋਈ ਕੋਪਰੇਸ਼ਨ ਨਹੀਂ ਦਿਖਾਇਆ ਜਾ ਰਿਹਾ ਸੀ ਅਤੇ ਉਹਦੇ ਲਈ ਵੀ ਮਤਲਬ ਐਨਾ ਤੰਗ ਪ੍ਰੇਸ਼ਾਨ ਹੋ ਗਈ ਸੀ ਕਿ ਲੱਗ ਰਿਹਾ ਸੀ ਕਿ ਇਹ ਹੀ ਬਹੁਤ ਵੱਡੀ ਪ੍ਰੋਬਲਮ ਹੈ ਕਿ ਇੱਕ ਬੈਂਕ ਦਾ ਖਾਤਾ ਖੁੱਲ੍ਹ ਜੇ ਇਹ ਹੀ ਬਹੁਤ ਵੱਡੀ ਗੱਲ ਹੈ ਅਤੇ ਪਰ ਉਹ ਵੀ ਜਿਹੜੀ ਸੀ ਉਹ ਹੁਣ ਛੋਟੀ ਜਿਹੀ ਗੱਲ ਲੱਗਣ ਲੱਗ ਗਈ ਹੈ ਕਿ ਇਹ ਤਾਂ ਛੋਟੀ ਜਿਹੀ ਹੈ ਬਟ ਉਦੋਂ ਉਮਰ ਦੇ ਹਿਸਾਬ ਨਾਲ ਜਾਂ ਆਪਣੇ ਜਿਹੜਾ ਹੈਗਾ ਹੈ ਕੋਈ ਐਕਸਪੀਰੀਐਂਸ ਨਹੀਂ ਸੀ ਬਾਹਰ ਨਿਕਲਣ ਦਾ ਇਹ ਵੀ ਬਹੁਤ ਵੱਡੀ ਚੁਣੌਤੀ ਲੱਗ ਰਹੀ ਸੀ